ਅੰਮ੍ਰਿਤਸਰ ਜ਼ਿਲ੍ਹਾ ਆਪਣੇ ਇਤਿਹਾਸਿਕ ਸਥਾਨਾਂ ਕਰਕੇ ਮਹੱਤਵਪੂਰਨ ਸਥਾਨਾਂ ਕਰਕੇ ਬਹੁਤ ਜ਼ਿਆਦਾ ਮਸ਼ਹੂਰ ਹੈ ਬੜਾ ਵੱਡਾ ਟੂਰਿਸਟ ਪਲੇਸ ਹੈ ਸਭ ਤੋਂ ਵੱਧ ਜਿਹੜੀ ਇਹਦੀ ਮਹੱਤਤਾ ਹੈ ਉਹ ਸ਼੍ਰੀ ਹਰਿਮੰਦਰ ਸਾਹਿਬ ਸਾਹਿਬ ਕਰਕੇ ਹੈ ਉਹਦੇ ਕਰਕੇ ਹੀ ਲੱਖਾਂ ਦੀ ਤਾਦਾਦ ਵਿੱਚ ਇੱਥੇ ਯਾਤਰੂ ਆਉਂਦੇ ਹਨ ਇੱਥੇ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਆਉਂਦੇ ਹਨ ਇੱਕ ਉੱਥੋਂ ਦੀ ਵਿਲੱਖਣਤਾ ਦੇਖਣ ਲਈ ਆਉਂਦੇ ਹਨ ਇੱਥੇ ਇੱਕ ਬਣਿਆ ਹੋਇਆ ਵਿਰਾਸਤੀ ਅਜਾਇਬ ਘਰ ਵੀ ਹੈ ਜਿ ਹਰਿਮੰਦਰ ਸਾਹਿਬ ਦੇ ਵਿੱਚ ਜਿਹੜਾ ਕਿ ਹਰ ਸਮੇਂ ਕੋਈ ਵੀ ਉੱਥੇ ਜਾ ਸਕਦਾ ਹੈ ਕੋਈ ਉਹਦੀ ਐਂਟਰੀ ਟਿਕਟ ਨਹੀਂ ਹੈ ਪਰ ਉਹਦਾ ਟਾਈਮ ਜਿਹੜਾ ਉਹ ਦਸ ਤੋਂ ਪੰਜ ਵਜੇ ਤੱਕ ਹੈ ਜਿਹੜਾ ਹਰਿਮੰਦਰ ਸਾਹਿਬ ਦੇ ਪਰਿਕਰਮਾ ਦੇ ਵਿੱਚ ਜਾਣ ਦਾ ਸਮਾਂ ਹੈ ਉਹ ਹਰ ਇੱਕ ਲਈ ਹਰ ਵੇਲੇ ਚੋਵੀ ਘੰਟੇ ਦਰਵਾਜੇ ਖੁੱਲ੍ਹੇ ਹਨ ਪਰ ਅੰਦਰ ਦਰਸ਼ਨਾਂ ਨੂੰ ਜਾਣ ਦਾ ਸਮਾਂ ਉੱਥੇ ਬੰਦਿਤ ਹੈ ਅਤੇ ਜਿਹੜੇ ਇੱਥੇ ਇੱਕ ਹੈਗਾ ਦੁਰਗਿਆਨਾ ਮੰਦਿਰ ਅੰਮ੍ਰਿਤਸਰ ਸ਼ਹਿ ਸਾਹਿਬ ਦੇ ਵਿੱਚ ਉਹ ਚੌਵੀ ਘੰਟੇ ਖੁੱਲ੍ਹਾ ਹੈ ਸਿਰਫ਼ ਮੰਦਿਰ ਦੇ ਕਵਾੜ ਰਾਤ ਦੇ ਸਮੇਂ ਬੰਦ ਹੋ ਜਾਂਦੇ ਹਨ ਅਤੇ ਇੱਥੇ ਇੱਕ ਵਿਰਾਸਤੀ ਅਜਾਇਬ ਘਰ ਹੈ ਜਿਹੜਾ ਕਿ ਕੁਤਵਾਲੀ ਚੌਂਕ ਦੇ ਵਿੱਚ ਹੈ ਉਹਦਾ ਵੀ ਇੱਕ ਟਾਈਮ ਹੈ ਦਸ ਤੋਂ ਪੰਜ ਵਜੇ ਤੱਕ ਖੁੱਲ੍ਹਦਾ ਹੈ ਪਰ ਉੱਥੇ ਇਕ ਐਂਟਰੀ ਟਿਕਟ ਹੈ ਜਿਹੜੀ ਪੰਦਰਾਂ ਜਾਂ ਵੀਹ ਰੁਪਏ ਦੀ ਹੈ ਹੋਰ ਇੱਥੇ ਅੰਮ੍ਰਿਤਸਰ 'ਚ ਵੇਖਣ ਵਾਲੀਆਂ ਇਤਿਹਾਸਿਕ ਥਾਵਾਂ ਇੱਕ ਗੋਬਿੰਦਗੜ ਕਿਲ੍ਹਾ ਹੈ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦਾ ਹੈ ਉਹਦੀ ਵੀ ਐਂਟਰੀ ਟਿਕਟ ਤਾਂ ਕੋਈ ਨਹੀਂ ਹੈ ਗੋਬਿੰਦਗੜ੍ਹ ਦਾ ਕਿਲ੍ਹਾ ਸ ਸਵੇਰੇ ਦਸ ਵਜੇ ਤੋਂ ਸ਼ਾਮ ਸੱਤ ਵਜੇ ਤੱਕ ਖੁੱਲ੍ਹਾ ਹੈ ਸ਼ਾਮ ਨੂੰ ਉੱਥੇ ਇੱਕ ਲਾਈਟ ਐਂਡ ਸਾਊਂਡ ਦਾ ਪ੍ਰੋਗਰਾਮ ਹੁੰਦਾ ਹੈ ਜਿਹਦੇ ਲਈ ਕਿ ਇੱਕ ਟਿਕਟ ਲੈਣੀ ਪੈਂਦੀ ਹੈ ਜਿਹਦੇ ਵਿੱਚ ਸਾਡੇ ਪੁਰਾਣੀ ਵਿਰਾਸਤ ਬਾਰੇ ਸਾਰੇ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦਾ ਸਾਰਾ ਕੁਛ ਉਹਦੇ ਵਿੱਚ ਬਿਆਨ ਕੀਤਾ ਜਾਂਦਾ ਹੈ ਜਿਸ ਨੂੰ ਦੇਖਣ ਲਈ ਲੋਕ ਬਹੁਤ ਦੂਰੋਂ ਦੂਰੋਂ ਆਉਂਦੇ ਹਨ ਲੋਕ ਅਕਸਰ ਆਪਣੀ ਖਾਲੀ ਸਮਾਂ ਬਤਾਉਣ ਲਈ ਇੱਥੋਂ ਦੇ ਪੁਰਾਣੇ ਬਾਗ ਜਿਹਨੂੰ ਕਿ ਕੰਪਣੀ ਬਾਗ ਦਾ ਨਾਂ ਦਿੱਤਾ ਜਾਂਦਾ ਹੈ ਉੱਥੇ ਆਪਣਾ ਸਮਾਂ ਬਿਤਾਉਣ ਲਈ ਜਾਂਦੇ ਹਨ ਉੱਥੇ ਬਹੁਤ ਸੋਹਣੀਆਂ ਕੁਦਰਤੀ ਦਰੱਖਤ ਬਹੁਤ ਸੋਹਣੀ ਹਰਿਆਲੀ ਹੈ ਲੋਕ ਆਪਣਾ ਸਮਾਂ ਬਤਾਉਣ ਲਈ ਉੱਥੇ ਜਾਂਦੇ ਹਨ ਬੜਾ ਸ਼ਾਂਤੀਪੂਰਨ ਮਾਹੌਲ ਹੁੰਦਾ ਹੈ ਜਿੱਥੇ ਇੱਕ ਉਹਦੀ ਇੱਕ ਸਾਈਡ 'ਤੇ ਥੋੜ੍ਹਾ ਜਿਹਾ ਮਿਊਜ਼ਿਕ ਦਾ ਪ੍ਰੋਗਰਾਮ ਹੈ ਜਿੱਥੇ ਹਰ ਵੇਲੇ ਹਲਕਾ ਹਲਕਾ ਜਿਹਾ ਮਿਊਜ਼ਿਕ ਚੱਲਦਾ ਰਹਿੰਦਾ ਹੈ ਲੋਕ ਉੱਥੇ ਬੈਠ ਕੇ ਆਪਣਾ ਸਮਾਂ ਬਿਤਾਉਂਦੇ ਹਨ ਅਤੇ ਬੜਾ ਉਸ ਜਗ੍ਹਾ ਨੂੰ ਇੰਜੋਏ ਕਰਦੇ ਹਨ ਅਨੰਦ ਲੈਂਦੇ ਹਨ